ਮੈਂ ਸੋਸ਼ਲ ਮੀਡੀਆ 'ਤੇ ਸਿਰਫ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਬੱਚਿਆਂ ਨੂੰ ਲੈ ਕੇ ਹੀ ਸਮਗਰੀ ਪਾਉਂਦੀ ਹਾਂ ਮੈਂ ਸੋਸ਼ਲ ਮੀਡੀਆ 'ਤੇ ਧਾਰਮਿਕ ਅਤੇ ਕੁਛ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੀਡੀਓ ਹੀ ਪਾਉਂਦੀ ਹਾਂ ਜਿਸ ਦੇ ਵਿੱਚ ਲੋਕਾਂ ਨੂੰ ਕੁਛ ਸਮਝ ਆਵੇ ਅਤੇ ਲੋਕਾਂ ਦੇ ਲੋਕ ਉਹਨਾਂ ਨੂੰ ਆਪਣੇ ਜੀਵਨ ਵਿੱਚ ਕੁਛ ਚੰਗੇ ਵਿਚਾਰਾਂ ਨੂੰ ਲੈ ਕੇ ਆਪਣੇ ਜੀਵਨ ਵਿੱਚ ਧਾਰਨ ਕਰਨ ਟੈਕਨੋਲੋਜੀ 'ਤੇ ਸੰਪਰਕ ਵਿੱਚ ਟੇ ਟੈਕਨੋਲੋਜੀ ਸਾਨੂੰ ਹੋਰ ਸੰਪਰਕ ਵਿੱਚ ਵਿੱਚ ਮਦਦ ਕਰ ਸਕਦੀ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਅਸੀਂ ਜਿਹਨਾਂ ਵਿਅਕਤੀਆਂ ਨੂੰ ਨਹੀਂ ਜਾਣਦੇ ਉਹ ਸਾਡੇ ਨਾਲ ਸੰਪਰਕ ਨਾ ਕਰਨ ਹਾਂਜੀ ਮੈਂ ਆਪਣੀ ਨਿੱਜਤਾ ਤੋਂ ਬਹੁਤ ਡਰਦੀ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਕੁਛ ਵੀ ਸੋਸ਼ਲ ਮੀਡੀਆ 'ਤੇ ਪਾਵਾਂ ਅਤੇ ਉਸ ਨਾਲ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੋਈ ਦੁੱਖ ਪਹੁੰਚੇ ਕਿਉਂਕਿ ਨਿੱਜਤਾ ਹੀ ਇੱਕ ਬਹੁਤ ਜ਼ਰੂਰੀ ਹੁੰਦੀ ਹੈ ਜਿਸ ਲਈ ਸ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਦੂਜੇ ਲੋਕਾਂ ਨੂੰ ਆਪਣੀ ਜ਼ਿੰਦਗੀ ਬਾਰੇ ਨਹੀਂ ਦੱਸਣਾ ਚਾਹੁੰਦੇ ਇਸ ਲਈ ਮੈਂ ਆਪਣੀ ਨਿੱਜਤਾ ਤੋਂ ਡਰਦੀ ਹਾਂ